ਹਾਂਜੀ ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਹੈ ਜਿਹੜਾ ਕਿ ਅਕਸਰ ਕੰਧਾਂ ਦੇ ਉੱਤੇ ਹੱਥ ਪੈਰ ਜਿਹੜੀ ਵੀ ਚੀਜ਼ ਆਉਂਦੀ ਆ ਉਹ ਰਗੜ ਦਿੰਦਾ ਹੈ ਜਿਸ ਦੇ ਨਾਲ ਕੰਧਾਂ ਚ 'ਤੇ ਸਕਰੈਚ ਪੈ ਜਾਂਦੇ ਹਨ ਇਹ ਸਕਰੈਚ ਦੇਖ ਕੇ ਮੇਰੇ ਅੰਦਰਲੀ ਕਲਾ ਜਾਗੀ ਅਤੇ ਜਿਸ ਦੇ ਕਰਕੇ ਮੈਂ ਆਪਣੀ ਕਲਾ ਨੂੰ ਕੰਧ ਦੇ ਉੱਤੇ ਹੀ ਉਸਾਰ ਦਿੱਤਾ ਜਿਸ ਦੇ ਵਿੱਚੋਂ ਮੈਂ ਉਸ ਸਕਰੈਚ ਦੀ ਮਦਦ ਦੇ ਨਾਲ ਇੱਕ ਘੋੜਾ ਬਣਾਇਆ ਹੈ ਉਹ ਬਹੁਤ ਸ਼ਾਨਦਾਰ ਅਤੇ ਪਵਿੱਤਰ ਸਾਫ ਸੁਥਰਾ ਬਹੁਤ ਸੋਹਣਾ ਚਿੱਤਰ ਬਣ ਗਿਆ ਜਿਸ ਦੇ ਕਰਕੇ ਮੇਰੀ ਰੂਹ ਨੂੰ ਸਕੂਨ ਮਿਲਿਆ ਅਤੇ ਸ਼ਾਂਤੀ ਪੂਰਵਕ ਮੈਂ ਉਸ ਤਸਵੀਰ ਨੂੰ ਰੋਜ਼ ਵੀ ਆਉਂਦੇ ਜਾਂਦੇ ਜਦੋਂ ਵੀ ਮੈਂ ਘਰ ਦੇ ਵਿੱਚ ਵੜਦਾ ਹਾਂ ਉਹ ਤਸਵੀਰ ਨੂੰ ਮੈਂ ਦੇ ਦੇਖਦਾਂ ਜਿਹਦੇ ਕਰਕੇ ਮੇਰੇ ਮਨ ਨੂੰ ਤਸੱਲੀ ਹੁੰਦੀ ਵੀ ਹਾਂ ਅੱਜ ਵੀ ਕਲਾ ਆਪਣੇ ਅੰਦਰ ਜ਼ਿੰਦਾ ਹੈ ਅਤੇ ਉਹ ਕਲਾ ਦੇ ਬਾਅਦ ਮੈਂ ਉਹ ਕਲਾ ਦੇ ਨਾਲ ਨਾਲ ਮੈਂ ਹੋਰ ਵੀ ਆਪਣੇ ਕਿੱਤੇ ਅਪਣਾਏ ਨੇ ਜਿਨ੍ਹਾਂ ਦੇ ਨਾਲ ਮੈਂ ਆਪਣੀ ਕਲਾ ਨੂੰ ਹੋਰ ਵੀ ਉਸਾਰਿਆ ਅਤੇ ਉਸ ਜਿਹੜੀ ਮੈਂ ਦੀਵਾਰ ਦੇ ਉੱਤੇ ਉਹ ਘੋੜੇ ਦੀ ਤਸਵੀਰ ਬਣਾਈ ਸੀ ਉਸ ਦੇ ਨਾਲ ਮੈਂ ਉਸਨੂੰ ਲਾਈਟਾਂ ਦੇ ਨਾਲ ਸਾਈਡਾਂ ਦੇ ਉੱਤੇ ਲਾਈਟਾਂ ਲਾ ਤੀਆਂ ਉਸਦੇ ਵਿੱਚ ਰੰਗ ਭਰਤੇ ਅਤੇ ਮੈਂ ਉਸ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਵਟ ਉਸਦੀ ਕੀਤੀ ਆ ਅਤੇ ਅਤੇ ਜਦੋਂ ਵੀ ਕੋਈ ਵੀ ਰਿਸ਼ਤੇਦਾਰ ਗੈਸਟ ਕੋਈ ਵੀ ਆਉਂਦਾ ਮਿੱਤਰ ਸੱਜਣ ਕੋਈ ਵੀ ਵੈਲੀ ਆਉਂਦਾ ਹੈ ਅਤੇ ਉਸ ਤਸਵੀਰ ਨੂੰ ਦੇਖਦਾ ਹੈ ਅਤੇ ਉਸ ਤਸਵੀਰ ਦੇ ਵਿੱਚ ਚਾਰ ਚੰਦ ਹੋਰ ਲੱਗ ਜਾਂਦੇ ਹਨ ਜਿਹੜੇ ਕਿ ਉਹਨਾਂ ਦੇ ਬੋਲਾਂ ਦੇ ਬੋਲ ਦੇ ਥਰੂ ਮੈਨੂੰ ਮਿਲਦੇ ਹਨ